ਮੇਰੀ ਮਨਪਸੰਦ ਖੇਡ ਖੋ ਖੋ ਹੈ ਬਚਪਨ ਵਿੱਚ ਮੈਂ ਖੋ ਖੋ ਖੇਡ ਬਹੁਤ ਖੇਡੀ ਅਤੇ ਸਕੂਲ ਲੈਵਲ 'ਤੇ ਵੀ ਖੇਡੀ ਹੈ ਖੋ ਖੋ ਵਿੱਚ ਦੋ ਟੀਮਾਂ ਹੁੰਦੀਆਂ ਹਨ ਅਤੇ ਹਰੇਕ ਟੀਮ ਵਿੱਚ ਅੱਠ ਖਿਡਾਰੀ ਹੁੰਦੇ ਹਨ ਅਤੇ ਚਾਰ ਸਪੇਅਰ ਖਿਡਾਰੀ ਹੁੰਦੇ ਹਨ ਅਤੇ ਜਿਹੜੀ ਟੀਮ ਦੀ ਬਾਰੀ ਹੁੰਦੀ ਹੈ ਉਹ ਟੀਮ ਨੀਚੇ ਉਲਟ ਦਿਸ਼ਾ ਵਿੱਚ ਬੈਠਦੀ ਹੈ ਅਤੇ ਉਸ ਟੀਮ ਦਾ ਇੱਕ ਖਿਡਾਰੀ ਦੂਜੀ ਟੀਮ ਦੇ ਤਿੰਨ ਖਿਡਾਰੀਆਂ ਨੂੰ ਛੂੰਹਦਾ ਹੈ ਅਤੇ ਜਿਸ ਜਦੋਂ ਇੱਕ ਖਿਡਾਰੀ ਛੂਹ ਦਿੱਤਾ ਜਾਂਦਾ ਹੈ ਤਾਂ ਉਹ ਖੇਡ ਤੋਂ ਬਾਹਰ ਹੋ ਜਾਂਦਾ ਹੈ